ਸਤਿ ਸ਼੍ਰੀ ਅਕਾਲ ਜੀ ਮੈਂ ਗੁਰਪ੍ਰੀਤ ਕੌਰ ਬੋਲ ਰਹੀ ਹਾਂ ਮੈਂ ਤਿੰਨ ਦਿਨ ਪਹਿਲੇ ਤੁਹਾਡੇ ਕੋਲੋਂ ਡਿਨਰ ਦੇ ਟਾਈਮ ਮੈਂ ਔਡਰ ਕੀਤਾ ਸੀਗਾ ਮੇਰੇ ਘਰ ਗੈਸਟ ਆਏ ਹੋਏ ਸੀਗੇ ਅਤੇ ਮੈਂ ਤੁਹਾਡੇ ਕੋਲੋਂ ਨਾਨ ਸ਼ਾਹੀ ਪਨੀਰ ਦਾਲ ਮੱਖਣੀ ਸਬਜ਼ੀ ਰਾਇਤਾ ਪਾਪੜ ਅਤੇ ਸੈਲਿਡ ਵਗੈਰਾ ਮੈਂ ਤੁਹਾਨੂੰ ਕੁਝ ਔਡਰ ਭੇਜਿਆ ਸੀਗਾ ਕਰਨ ਵਾਸਤੇ ਅਤੇ ਤੁਸੀਂ ਕਿਹਾ ਸੀਗਾ ਕਿ ਡਿਲੀਵਰੀ ਬੋਏ ਥੋੜ੍ਹੇ ਦੇਰ ਵਿੱਚ ਆ ਜਾਵੇਗਾ ਬਟ ਜਿਹੜਾ ਡਿਲੀਵਰੀ ਬੋਆਏ ਸੀਗਾ ਉਹ ਕਾਫੀ ਦੇਰ ਤੱਕ ਆਇਆ ਨਹੀਂ ਅਤੇ ਮੈਨੂੰ ਓਨ ਦੀ ਸਪੋਟ ਉਸੇ ਟਾਈਮ ਮੈਨੂੰ ਔਡਰ ਕੈਂਸਲ ਕਰਨਾ ਪਿਆ ਕਿਉਂਕਿ ਮੇਰੇ ਗੈਸਟ ਵੇਟ ਕਰ ਰਹੇ ਸੀਗੇ ਅਤੇ ਔਡਰ ਮੇਰੇ ਕੋਲ ਆ ਨਹੀਂ ਸੀ ਰਿਹਾ ਤਾਂ ਇਸ ਵਜ੍ਹਾ ਕਰਕੇ ਫਿਰ ਮੈਂ ਤੁਹਾਨੂੰ ਕਾਲ ਕੀਤੀ ਬਟ ਤੁਹਾਨੂੰ ਵੀ ਨਹੀਂ ਕੁਝ ਵੀ ਪਤਾ ਸੀਗਾ ਕਿ ਤੁਹਾਡਾ ਡਿਲੀਵਰੀ ਬੋਆਏ ਜਿਹੜਾ ਹੈ ਉਹ ਸਾਡੇ ਕੋਲ ਆਇਆ ਨਹੀਂ ਹੈਗਾ ਅਤੇ ਫਿਰ ਤੁਸੀਂ ਮੈਨੂੰ ਕਿਹਾ ਸੀਗਾ ਕਿ ਅਸੀਂ ਤੁਹਾਡਾ ਜਿਹੜਾ ਰਿਫੰਡ ਹੈ ਉਹ ਅਸੀਂ ਤੁਹਾਨੂੰ ਔਨਲਾਈਨ ਕਰ ਦਿਆਂਗੇ ਬਟ ਤੁਸੀਂ ਹੁਣ ਤੱਕ ਕੀਤਾ ਨਹੀਂ ਹੈਗਾ ਅਤੇ ਮੈਂ ਕਾਫੀ ਟਾਈਮ ਤੋਂ ਵੇਟ ਕਰ ਰਹੀ ਸੀਗੀ ਤਾਂ ਹੀ ਮੈਂ ਅੱਜ ਤੁਹਾਨੂੰ ਕੋਲ ਕੀਤੀ ਹੈ ਮੇਰਾ ਘਰ ਜਿਹੜਾ ਹੈ ਉਹ ਤੁਹਾਡੇ ਢਾਬੇ ਦੇ ਬਿਲਕੁਲ ਨੇੜੇ ਹੀ ਹੈਗਾ ਏ ਅਗਰ ਤੁਸੀਂ ਪੇਮੈਂਟ ਮੇਰੀ ਔਨਲਾਈਨ ਰਿਫੰਡ ਨਹੀਂ ਕਰ ਸਕਦੇ ਤਾਂ ਮੈਂ ਖੁਦ ਆ ਕੇ ਆਪਣਾ ਕੈਸ਼ ਵਾਪਿਸ ਲੈ ਸਕਦੀ ਹਾਂ ਉਹ ਤੁਹਾਨੂੰ ਜਿੱਦਾਂ ਵੀ ਠੀਕ ਲੱਗਦਾ ਤੁਸੀਂ ਮੈਨੂੰ ਕੋਲ ਕਰਕੇ ਇਨਫੋਰਮ ਕਰ ਦਿਓ ਮੈਂ ਤੁਹਾਡੇ ਕੋਲ ਆ ਜਾਵਾਂਗੀ ਅਤੇ ਤੁਹਾਡੇ ਕੋਲ ਆ ਕੇ ਆਪਣਾ ਕੈਸ਼ ਜਿਹੜਾ ਏ ਕਲੈਕਟ ਕਰ ਲਵਾਂਗੀ